ਪਾਣੀ ਦਾ ਸ਼ੁੱਧ ਅਤੇ ਸਾਫ਼ ਹੋਣਾ ਬਹੁਤ ਜਰੂਰੀ ਹੈ ਜਿਸ ਲਈ ਪਾਣੀ ਨੂੰ ਅੱਜ ਕੱਲ ਸਭ ਲੋਕ ਫਿਲਟਰ ਕੀਤਾ ਹੋਇਆ ਪਾਣੀ ਹੀ ਵਰਤ ਰਹੇ ਹਨ ਅਤੇ ਇਸ ਪਾਣੀ ਦਾ ਸ਼ੁੱਧ ਹੋਣਾ ਜਰੂਰੀ ਹੈ ਕਿਉਂਕਿ ਅੱਜ ਅੱਜ ਕੱਲ ਬਿਮਾਰੀਆਂ ਬਹੁਤ ਵੱਧ ਗਈਆਂ ਹਨ ਤੇ ਤੈਕਨੋਲਜੀ ਵਧਣ ਦੇ ਨਾਲ ਲੋਕਾਂ ਨੇ ਘਰ ਘਰ ਵਿੱਚ ਫਿਲਟਰ ਲਵਾਏ ਹੋਏ ਹਨ ਅਤੇ ਫਿਲਟਰ ਲੋਕ ਜਿਆਦਾ ਫਿਲਟਰ ਵਾਲਾ ਪਾਣੀ ਹੀ ਵਰਤ ਰਹੇ ਹਨ ਅਤੇ ਇਹ ਜਰੂਰੀ ਵੀ ਹੈ ਕਿਉਂਕਿ ਬਿਮਾਰੀਆਂ ਤੋਂ ਬਚਣ ਦਾ ਸਿਰਫ ਇਹੀ ਤਰੀਕਾ ਹੈ ਕਿਉਂਕਿ ਸ਼ੁੱਧ ਪਾਣੀ ਪੀਵਾਂਗੇ ਤੇ ਆਪਾਂ ਫਿਰ ਹੀ ਤੰਦਰੁਸਤ ਰਹਿ ਸਕਦੇ ਹਾਂ ਅਤੇ ਲੋਕਾਂ ਨੇ ਘਰ ਘਰ ਫਿਲਟਰ ਲਗਾਉਣ ਤੋਂ ਇਲਾਵਾ ਸ਼ਹਿਰਾਂ ਵਿੱਚ ਆਮ ਹੀ ਆਰਓ ਵਗੈਰਾ ਲੱਗੇ ਹੋਏ ਹਨ ਜਿੱਥੇ ਕਿ ਲੋਕਾਂ ਨੂੰ ਗਲੀਆਂ ਵਿੱਚ ਆਟੋ ਤੇ ਪਾਣੀ ਮੁਹਈਆ ਕਰਵਾਇਆ ਜਾਂਦਾ ਹੈ ਅਤੇ ਪੰਜ ਰੁਪਏ ਦੀ ਕੈਨੀ ਦਿੱਤੀ ਜਾਂਦੀ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਆਸਾਨ ਹੋ ਗਿਆ ਹੈ ਅਤੇ ਇਸ ਤੋਂ ਇਲਾਵਾ ਜੇ ਆਪਾਂ ਘਰ ਵਿੱਚ ਵੀ ਸ਼ੁੱਧ ਪਾਣੀ ਜੇ ਫਿਲਟਰ ਵਾਲਾ ਪਾਣੀ ਨਹੀਂ ਲੈਂਦੇ ਸ਼ੁੱਧ ਪਾਣੀ ਪੀਣਾ ਹੈ ਤਾਂ ਆਪਾਂ ਘਰ ਵਿੱਚ ਵੀ ਫਟਕੜੀ ਦੀ ਵਰਤੋਂ ਕਰ ਸਕਦੇ ਹਾਂ ਫਟਕੜੀ ਦੀ ਵਰਤੋਂ ਕਰਨ ਵਾਸਤੇ ਉਹ ਪਾਣੀ ਵਿੱਚ ਫਟਕੜੀ ਨੂੰ ਪਾ ਕੇ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਚਾਹੀਦਾ ਹੈ ਅਤੇ ਇਸ ਇਸ ਨਾਲ ਉਹਦੇ ਜਿਹਨ ਦੇ ਜਿਹੜੇ ਉਹਨਦੇ ਵਿੱਚ ਕੀਟਾਣੂ ਹੁੰਦੇ ਹਨ ਉਹ ਮਰ ਜਾਂਦੇ ਹਨ ਅਤੇ ਪਾਣੀ ਸ਼ੁੱਧ ਅਤੇ ਸਾਫ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਪਾਣੀ ਨੂੰ ਠੰਡਾ ਹੋਣ ਤੋਂ ਬਾਅਦ ਆਪਾਂ ਫਟਕੜੀ ਵਾਲੇ ਪਾਣੀ ਨੂੰ ਵਰਤ ਸਕਦੇ ਹਨ ਜੋ ਕਿ ਸਿਹਤ ਵਾਸਤੇ ਬਹੁਤ ਹੀ ਵਧੀਆ ਅਤੇ ਫਾਇਦੇਮੰਦ ਹੈ ਅੱਜ ਕੱਲ ਸਭ ਨੂੰ ਸ਼ੁੱਧ ਅਤੇ ਸਾਫ ਸੁਥਰਾ ਪਾਣੀ ਪੀਣਾ ਚਾਹੀਦਾ ਹੈ